ਜਲੰਧਰ ਪ੍ਰਾਚੀਨ ਮੱਧਕਾਲੀ ਅਤੇ ਆਧੁਨਿਕ ਦੌਰ ਦਾ ਸੁਮੇਲ ਹੈ ਜਲੰਧਰ ਇੱਕ ਪੂਤ ਰਾਜੇ ਨੇ ਜਿਸ ਦਾ ਜਿਕਰ ਕੁਰਾਨ ਅਤੇ ਗੀਤਾ ਵਿੱਚ ਕੀਤਾ ਗਿਆ ਹੈ ਇੱਕ ਹੋਰ ਕਥਾ ਅਨੁਸਾਰ ਜਲੰਧਰ ਲਵ ਰਾਮ ਪੁੱਤਰ ਦੇ ਰਾਜ ਦੀ ਰਾਜਧਾਨੀ ਸੀ ਇੱਕ ਹੋਰ ਵਰਜ਼ਨ ਦੇ ਅਨੁਸਾਰ ਜਲੰਧਰ ਭਾਸ਼ਾਈ ਮਿਆਦ ਜਲੰਧਰ ਦਾ ਮਤਲਬ ਹੈ ਪਾਣੀ ਦੇ ਅੰਦਰ ਦੇ ਖੇਤਰ ਭਾਵ ਦੋ ਦਰਿਆ ਸਤਲੁਜ ਅਤੇ ਬਿਆਸ ਦੇ ਵਿਚਕਾਰ ਇਹ ਇਲਾਕਾ ਜਲੰਧਰ ਖੇਤਰ ਸਿੰਧੂ ਘਾਟੀ ਸਭਿਅਤਾ ਦਾ ਹਿੱਸਾ ਸੀ ਜਲੰਧਰ ਜ਼ਿਲ੍ਹੇ ਦਾ ਆਧੁਨਿਕ ਇਤਿਹਾਸ ਕਹਿੰਦਾ ਹੈ ਕਿ ਖਿਲਾਫਤ ਅੰਦੋਲਨ ਉੱਨੀ ਸੋ ਵੀਹ ਵਿੱਚ ਜਲੰਧਰ ਜ਼ਿਲ੍ਹੇ ਵਿੱਚ ਸ਼ੁਰੂ ਕੀਤਾ ਗਿਆ ਸੀ ਜਲੰਧਰ ਇਸ ਦੇਸ਼ ਦੀ ਵੰਡ ਨੇ ਫਿਰਕੂ ਦੰਗੇ ਅਤੇ ਸਰਹੱਦ ਦੇ ਦੋਨੋਂ ਪਾਸੇ ਤੱਕ ਘੱਟ ਗਿਣਤੀ ਭਾਈਚਾਰੇ ਪ੍ਰਭਾਵਿਤ ਕੀਤਾ ਜਲੰਧਰ ਇੱਕ ਰਾਕਸ਼ਸ ਦਾ ਨਾਮ ਵੀ ਸੀ ਜਿਹਦੇ ਤੋਂ ਇਸ ਦਾ ਨਾਮ ਵੀ ਜਲੰਧਰ ਪਿਆ ਅਤੇ ਜਲੰਧਰ ਦੀਆਂ ਮੁੱਖ ਘਟਨਾਵਾਂ ਦੋ ਹਜ਼ਾਰ ਦੋ ਦੋ ਸ਼ੁੰਨਿਆ ਸ਼ੁੰਨਿਆ ਦੋ ਵਿੱਚ ਇੱਥੇ ਮਿਗ ਦੋ ਵਨ ਜਹਾਜ਼ ਡਿੱਗਿਆ ਸੀ ਜਿਸ ਨਾਲ ਕਾਫੀ ਬੰਦੇ ਮਰ ਗਏ ਸੀ ਅਤੇ ਦੋ ਜ਼ੀਰੋ ਇੱਕ ਤਿੰਨ ਵਿੱਚ ਇੱਥੇ ਬਸ ਐਕਸੀਡੈਂਟ ਵੀ ਹੋਇਆ ਸੀ ਜਿਸ ਵਿੱਚ ਕਾਫੀ ਬੱਚੇ ਮਰ ਗਏ ਸੀ ਸਕੂਲ ਦੇ ਲਾਲਾ ਲਾਜਪਤ ਰਾਏ ਇੱਥੋਂ ਦੇ ਮਸ਼ਹੂਰ ਮਸ਼ਹੂਰ ਆਜ਼ਾਦੀ ਦਿਵਾਉਣ ਵਾਲੇ ਬੰਦੇ ਸੀ ਉਸ ਨੇ ਪੰਜਾਬ ਨੈਸ਼ਨਲ ਬੈਂਕ ਅਤੇ ਲਕਸ਼ਮੀ ਬੀਮਾ ਕੰਪਨੀ ਦੀ ਸਥਾਪਨਾ ਕੀਤੀ ਸੀ ਇਹ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਵਿੱਚ ਵੀ ਸੀਗੇ ਕਾਫੀ ਕੁਛ ਇਹਨਾਂ ਨੇ ਕੀਤਾ ਕਾਫੀ ਅਜ਼ਾਦੀ ਦੌਰਾਨ ਵੀ ਇਹਨਾਂ ਨੇ ਕਾਫੀ ਜ਼ਿਆਦੀ ਕਾ ਅਹਿਮ ਭੂਮਿਕਾ ਨਿਭਾਈ